ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਕਰਦਾਂਗੇ ਹਾਂਜੀ ਹਾਂਜੀ ਉਹਦਾ ਚਾਰ ਪੰਜ ਹਜ਼ਾਰ ਰੁਪਇਆ ਲੱਗ ਜਾਵੇਗਾ ਜੀ ਨਵਾਂ ਜੀ ਤੁਹਾਨੂੰ ਦਸ ਕੁ ਹਜ਼ਾਰ ਦਾ ਪੈ ਜਾਵੇਗਾ ਜੀ ਵਿੱਚ ਦੇ ਕੇ ਉਹ ਹਾਂਜੀ ਹਾਂਜੀ ਹਾਂਜੀ ਉਹ ਬਦਲ ਦੇਵਾਂਗੇ ਜੀ ਹਾਂਜੀ ਉਹ 'ਤੇ ਖਰਚਾ ਆ ਹੀ ਜਾਣਾ ਜੀ ਪੰਜ ਛੇ ਹਜ਼ਾਰ ਰੁਪਈਆ ਲੱਕੜ ਵਧੀਆ ਲਾਵਾਂਗੇ ਜੀ ਸਾਗਵਾਨ ਦੀ ਜਾਂ ਟਾਹਲੀ ਦੀ ਜਾਂ ਫਿਰ ਸੀਲ ਦੀ ਸੀਲ ਦੀ ਲੱਕੜ ਲੱਗਦੀ ਹੈ ਜੀ ਹਾਂਜੀ ਉਹ ਪੰਜ ਛੇ ਹਜ਼ਾਰ ਰੁਪਇਆ ਆ ਜਾਵੇਗਾ ਜੀ ਹਾਂਜੀ ਗਰੰਟੀ ਹੈ ਜੀ ਵਧੀਆ ਲੱਕੜ ਲਾ ਕੇ ਬਣਾ ਕੇ ਦੇਵਾਂਗੇ ਜੀ ਤਸੱਲੀ ਬਖ਼ਸ਼ ਕੰਮ ਕਰਕੇ ਦੇਵਾਂਗੇ ਨਹੀਂ ਜੀ ਪੂਰੀ ਵਧੀਆ ਲੱਕੜ ਲਾ ਕੇ ਦੇਵਾਂਗੇ ਜੀ ਹਾਂਜੀ ਉਹ ਵੀ ਕਰ ਦੇਵਾਂਗੇ ਉਹਨੂੰ ਵੀ ਐਕਸਟਰਾ ਪੈਸੇ ਲੱਗ ਜਾਣਗੇ ਉਹ ਦੇਖੋ ਜੀ ਜਿੰਨਾ ਕੁ ਟੈਮ ਲੱਗੂਗਾ ਜਿਹਦੇ ਹਿਸਾਬ ਨਾਲ ਮਤਲਬ ਉਹ ਫੈਕਚਰ ਹੋਈਆਂ ਵੀ ਹੋਣਗੀਆਂ ਉਹਦੇ ਹਿਸਾਬ ਨਾਲ ਉਹਦੀ ਪੇਮੈਂਟ ਹੋ ਜਾਵੇਗੀ ਜੀ ਜਿੰਨਾ ਕੁ ਟੈਮ ਉਹ 'ਤੇ ਲੱਗੂਗਾ ਉਹਦੇ ਹਿਸਾਬ ਨਾਲ ਲੈ ਲਾਂਗੇ ਹਾਂਜੀ ਹਾਂਜੀ ਬਹੁਤ ਵਧੀਆ ਬਣਾ ਦੇਵਾਂਗੇ ਜੀ ਬਾਰਨਿਸ਼ ਪਾਲਸ਼ ਵੀ ਸਾਰਾ ਕੁਛ ਕਰ ਦੇਵਾਂਗੇ ਜੀ ਨਵਾਂ ਬਣਾ ਕੇ ਬਿਲਕੁਲ ਨਹੀਂ ਪਤਾ ਲੱਗਣਾ ਨਵਾਂ ਜਾ ਪੁਰਾਣਾ ਫਰਨੀਚਰ ਹੈ ਤੁਹਾਡਾ ਮਤਲਬ ਸਾਰਾ ਕੁਛ ਉੱਪਰ ਨਵਾਂ ਕਰ ਦੇਵਾਂਗੇ ਜੀ ਉਹਨੂੰ ਪਾਲਿਸ਼ ਵੀ ਕਰ ਦੇਵਾਂਗੇ ਬਾਰਨਿਸ਼ ਪਾਲਿਸ਼ ਵੀ ਕਰ ਦੇਵਾਂਗੇ ਪਤਾ ਹੀ ਨਹੀਂ ਲੱਗਣਾ ਜੀ ਪੁਰਾਣਾ ਹੈ ਕਿ ਨਵਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਕਰ ਦੇਵਾਂਗੇ ਬੰਦਾ ਵਰਕਰ ਭੇਜ ਦੇਵਾਂਗੇ ਜੀ ਉਹ ਕਰ ਦੇਵੇਗਾ ਜੇ ਤਾਂ ਜੀ ਜ਼ਿਆਦੇ ਉਪਰੋਂ ਖ਼ਰਾਬ ਹੋਈ ਵੀ ਹੋਉਗੀ ਤਾਂ ਤਾਂ ਨਹੀਂ ਪਲਾਈ ਲੱਗਣੀ ਹੈਗੀ ਜੇ ਥੋੜ੍ਹੀ ਘੱਟ ਖ਼ਰਾਬ ਹੋਈ ਹੋਉਗੀ ਪਲਾਈ ਤਾਂ ਉਹਦੇ ਉੱਤੇ ਸਰਮੈਕਾ ਲੱਗ ਜਾਵੇਗਾ ਜੀ ਜੰਮ ਜੂਗਾ ਹਾਂਜੀ ਵਧੀਆ ਦਾਣੇਦਾਰ ਲਾਵਾਂਗੇ ਜੀ ਜਿਹਦੇ 'ਤੇ ਲਕੀਰ ਮਾਰੇ ਤੋਂ ਝਰੀਟ ਨਹੀਂ ਪੈਂਦੀ ਉਹ ਲਾਵਾਂਗੇ ਜੀ ਹਾਂਜੀ ਹਾਂਜੀ ਵਧੀਆ ਹੀ ਲਵਾਂਗੇ ਦਾਣੇਦਾਰ ਸਰਮੈਕਾ ਲਾਵਾਂਗੇ ਜੀ ਬਹੁਤ ਵਧੀਆ ਹੁੰਦਾ ਉਹ ਖ਼ਰਾਬ ਨਹੀਂ ਹੁੰਦਾ ਉਹ ਚਿਰ ਓਕੇ ਜੀ